ਕਿਉਂਕਿ ਅਸੀਂ ਮੈਂ ਸਿੱਖ ਧਰਮ ਨਾਲ ਸੰਬੰਧਿਤ ਹਾਂ ਅਤੇ ਸਾਡੇ ਧਰਮ ਦੇ ਵਿੱਚ ਨਿਰਗੁਣ ਸਰੂਪ ਦੀ ਹੀ ਪੂਜਾ ਕਰਨ ਲਈ ਕਿਹਾ ਹੈ ਸਰਗੁਣ ਸਰੂਪ ਦੀ ਪੂਜਾ ਲਈ ਗੁਰੂ ਸਾਹਿਬ ਨੇ ਬਹੁਤ ਇਸ ਦਾ ਖੰਡਨ ਕੀਤਾ ਹੈ ਨਿਰਗੁਣ ਸਰੂਪ ਜਿਹੜਾ ਹੁੰਦਾ ਹੈ ਉਹਦੇ ਵਿੱਚ ਆਕਾਰ ਤੋਂ ਰਹਿਤ ਹੈ ਉਸ ਦੀ ਸਾਨੂੰ ਪ੍ਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇ ਘਰ ਨੇ ਉਸ ਨਾਲ ਜੋੜਿਆ ਹੈ ਅਤੇ ਬਾਕੀ ਜਿਹੜੇ ਨੌਂ ਗੁਰੂ ਸਾਹਿਬਾਨ ਨੇ ਉਨ੍ਹ ਉਹ ਵੀ ਉਹਨਾਂ ਦੇ ਬਣਾਏ ਹੋਏ ਪੂਰਨਿਆਂ 'ਤੇ ਹੀ ਚੱਲੇ ਹਨ ਅਤੇ ਸਾਡੇ ਧਰਮ ਦੇ ਵਿੱਚ ਮੂਰਤੀਆਂ ਦੀ ਪੂਜਾ ਦਾ ਕੋਈ ਇਸਦਾ ਸਥਾਨ ਨਹੀਂ ਹੈ ਇਸ ਲਈ ਮੇਰੇ ਲਈ ਕੋਈ ਇਹਦਾ ਕੋਈ ਖਾਸ ਮਹੱਤਵ ਨਹੀਂ ਹੈ ਮੂਰਤੀ ਪੂਜਾ ਦਾ ਜਿਵੇਂ ਕਿ ਸਾਨੂੰ ਨਿਰੰਕਾਰ ਦੀ ਪੂਜਾ ਲਈ ਹੀ ਗੁਰੂ ਸਾਹਿਬ ਨੇ ਪ੍ਰੇਰਿਆ ਹੈ